ਅਗਰ ਆਪਾਂ ਗੱਲ ਕਰੀਏ ਘੋੜਿਆਂ ਦੀ ਤਾਂ ਘੋੜਿਆਂ ਦਾ ਨਿਹੰਗ ਸਿੰਘਾਂ ਨਾਲ ਉਹ ਬਹੁਤ ਹੀ ਗਹਿਰਾ ਅਤੇ ਪਾਰੰਪਰਿਕ ਰਿਸ਼ਤਾ ਹੈ ਕਿਉਂਕਿ ਸਭ ਤੋਂ ਪਹਿਲਾਂ ਸਿੱਖ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜਿਆਂ ਨੂੰ ਇੱਕ ਵੱਖਰਾ ਦਰਜਾ ਦਿੱਤਾ ਅਤੇ ਇਸ ਤੋਂ ਬਾਅਦ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਇਹਨਾਂ ਬਾਰੇ ਘੋੜਿਆਂ ਬਾਰੇ ਇਹਨਾਂ ਨੂੰ ਬਹੁਤ ਹੀ ਆਪਣਾ ਆਪਣੇ ਸਿੱਖ ਕਮਿਊਨਿਟੀ ਜਾਤੀ ਦੇ ਵਿੱਚ ਬਹੁਤ ਹੀ ਦਰਜਾ ਦਿੱਤਾ ਹੈ ਕਿਉਂਕਿ ਅਗਰ ਆਪਾਂ ਗੱਲ ਕਰੀਏ ਹੋਲੇ ਮਹੱਲੇ ਦੀ ਤਾਂ ਉੱਥੇ ਇਹਨਾਂ ਦਾ ਹੋਲੇ ਮਹੱਲੇ ਦੇ ਵਿੱਚ ਘੋੜਿਆਂ ਦੀ ਉੱਥੇ ਰੇ ਰੇਸ ਕਰਵਾਈ ਜਾਂਦੀ ਹੈ ਜਿੱਥੇ ਕਿ ਹਰ ਤਰ੍ਹਾਂ ਦੇ ਘੋੜੇ ਹੋਲੇ ਮਹੱਲੇ 'ਤੇ ਉੱਥੇ ਪਹੁੰਚਦੇ ਹਨ ਥੈਂਕ ਯੂ ਸੋ ਮਚ